ਤੁਹਾ ਸਾਡੇ ਸੱਭਿਆਚਾਰ ਵਿੱਚ ਔਰਤਾਂ ਵਿੱਚ ਮਹਾਂਮਾਰੀ ਦਾ ਇਲਾਜ ਬਹੁਤ ਪੁਰਾਣੇ ਸਮਿਆਂ ਵਿੱਚ ਬਹੁਤ ਘਟੀਆ ਸੀ ਔਰਤਾਂ ਨੂੰ ਕੱਪੜਾ ਯੂਜ਼ ਕਰਨਾ ਪੈਂਦਾ ਸੀ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੀ ਇੰਨਫੈਕਸ਼ਨ ਵੀ ਹੋ ਜਾਂਦੀ ਸੀ ਅਤੇ ਉਹ ਦੱਸਣ ਵਿੱਚ ਵੀ ਬਹੁਤ ਬਹੁਤ ਝਿਜਕ ਮੰਨ ਮੰਨਦੇ ਸਨ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਸੀ ਅਤੇ ਇਸ ਸਮੇਂ ਵਿੱਚ ਤਾਂ ਬਹੁਤ ਤਰ੍ਹਾਂ ਦੀਆਂ ਤਕਨੋਲਜੀਆਂ ਆ ਗਈਆਂ ਹਨ ਕਿ ਉਹ ਉਨ੍ਹਾਂ ਨੂੰ ਸੈਨੇਟਾਈਜ਼ ਪੈਡ ਅਤੇ ਅਤੇ ਹੋਰ ਤਰ੍ਹਾਂ ਦੀਆਂ ਚੀਜ਼ਾਂ ਵੀ ਮਿਲ ਰਹੀਆਂ ਹਨ ਅਤੇ ਹੁਣ ਕੋਈ ਵੀ ਇੰਨਫੈਕਸ਼ਨ ਹੋਣ ਤੋਂ ਬੱਚ ਸਕਦਾ ਹੈ ਅਤੇ ਹੁਣ ਬਹੁਤ ਸਵਸ ਅਤੇ ਇਹਨਾਂ ਨੂੰ ਅਤੇ ਦਸ ਇਹ ਮਹਾਂਮਾਰੀ ਨੂੰ ਦੱਸਣ ਵਿੱਚ ਕਿਸੇ ਨੂੰ ਝਿਜਕ ਵੀ ਨਹੀਂ ਆਉਂਦੀ ਅਤੇ ਅਸੀਂ ਕਿਸੇ ਨੂੰ ਵੀ ਅਸਾਨੀ ਨਾਲ਼ ਦੱਸ ਸਕਦੇ ਹਾਂ ਅਸੀਂ ਹੁਣ ਡੋਕਟਰਾਂ ਅਤੇ ਔਰਤਾਂ ਬੰਦਿਆਂ ਨੂੰ ਵੀ ਦੱਸ ਸਕਦੀ ਹੈ ਕਿ ਅਤੇ ਉਹ ਵੀ ਕੋਈ ਝਿਜਕ ਨਹੀਂ ਮੰਨਦੀ